ਮੈਂ ਇੱਕ ਸਫ਼ਲ ਕਿਸਾਨ ਹਾਂ ਜੋ ਕਿ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਹਾਂ ਜਿਸ ਵਿੱਚ ਖੇਤੀਬਾੜੀ ਦਫ਼ਤਰਾਂ ਵੱਲੋਂ ਸੰਚਾਰੂ ਰੂਪ ਵਿੱਚ ਖੇਤੀਬਾੜੀ ਸੰਮੇਲਨ ਕਰਵਾਏ ਜਾਂਦੇ ਹਨ ਇਹ ਸੰਮੇਲਨ ਜ਼ਿਲ੍ਹਾ ਪੱਧਰ ਬਲਾਕ ਪੱਧਰ ਜਾਂ ਪਿੰਡ ਪੱਧਰ 'ਤੇ ਕਰਵਾਏ ਜਾਂਦੇ ਹਨ ਇਹਨਾਂ ਸੰਮੇਲਨਾਂ ਦੌਰਾਨ ਕਿਸਾਨਾਂ ਨੂੰ ਵੱਖ ਵੱਖ ਬੀਮਾ ਪੋਲਸੀਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਇਹਨਾਂ ਬੀਮਾ ਪੋਲਸੀਆਂ ਦੇ ਨਾਲ ਨਾਲ ਕਿਸਾਨਾਂ ਨੂੰ ਫ਼ਸਲਾਂ ਦੇ ਬੀਜਾਂ ਬਾਰੇ ਫ਼ਸਲਾਂ ਦੇ ਸਾਂਭ ਸੰਭਾਲ ਬਾਰੇ ਫ਼ਸਲਾਂ ਦੇ ਰਹਿੰਦ ਖੂੰਹਦ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਜਦੋਂ ਇਹ ਸੰਮੇਲਨ ਕਰਵਾਏ ਜਾਂਦੇ ਹਨ ਤਾਂ ਉਹਨਾਂ ਸੰਮੇਲਨਾਂ ਦੇ ਦੌਰਾਨ ਬਹੁਤ ਸਾਰੇ ਕਿਸਾਨਾਂ ਦੇ ਬਹੁਤ ਸਾਰੇ ਪ੍ਰਸ਼ਨ ਸਾਹਮਣੇ ਆਉਂਦੇ ਹਨ ਜਿਹਨਾਂ ਪ੍ਰਸ਼ਨਾਂ ਤੋਂ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਜਿਵੇਂ ਕਿ ਫ਼ਸਲ ਬੀਮਾ ਪੋਲਸੀ ਸੰਮੇਲਨ ਦੇ ਦੌਰਾਨ ਜੇਕਰ ਹਿੱਸਾ ਲਿਆ ਉਸ ਦੇ ਵਿੱਚ ਮੈਂ ਉਹਨਾਂ ਦੇ ਵਿਕਲਪਾਂ ਨੂੰ ਉਹਨਾਂ ਦੀਆਂ ਨੀਤੀਆਂ ਨੂੰ ਜਾਂ ਉਹਨਾਂ ਦੀਆਂ ਯੋਜਨਾਵਾਂ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਸੁਣਿਆ ਪਰੰਤੂ ਇਸ ਸੰਮੇਲਨ ਵਿੱਚ ਹਿੱਸਾ ਲੈਣ 'ਤੇ ਮੈਨੂੰ ਇਹ ਚੀਜ਼ਾਂ ਸਾਹਮਣੇ ਆਈਆਂ ਕਿ ਬੀਮਾ ਪੋਲਸੀ ਜੇਕਰ ਕਿਸਾਨ ਨੂੰ ਕਰਕੇ ਦਿੱਤੀ ਜਾਵੇ ਤਾਂ ਕੇਂਦਰ ਸਰਕਾਰ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਜੇਕਰ ਇਸ ਉਪਰਾਲੇ ਦੇ ਵਿੱਚ ਮੈਂ ਕੁਝ ਸੀਮਾਵਾਂ ਦੀ ਗੱਲ ਕਰਾਂ ਕੁਝ ਵਿਕਲਪ ਜਿਹੜੇ ਕਿਸਾਨਾਂ ਦੇ ਸਾਹਮਣੇ ਆਉਂਦੇ ਹੈ ਉਹਨਾਂ ਦੀ ਗੱਲ ਕਰਾਂ ਜਿਵੇਂ ਕਿ ਗੜੇਮਾਰੀ ਕੁਦਰਤੀ ਆਫ਼ਤਾਂ ਸੋਕਾ ਹੜ੍ਹ ਦੀ ਸਮੱਸਿਆ ਆਮ ਦੇਖਣ ਵਿੱਚ ਮਿਲਦੀ ਹੈ ਜਿਸ ਦੇ ਵਿੱਚ ਇੱਕ ਬੀਮਾ ਪੋਲਸੀ ਦੇ ਦੌਰਾਨ ਕਿਸਾਨ ਨੂੰ ਕੁਝ ਹਿੱਸਾ ਫ਼ਸਲ ਦਾ ਕੁਝ ਹਿੱਸਾ ਇੱਕ ਬੀਮਾ ਪੋਲਸੀ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ ਜੇਕਰ ਦੇਖਿਆ ਜਾਵੇ ਤਾਂ ਸਭ ਤੋਂ ਵੱਡੀ ਸੀਮਾ ਜਾਂ ਸਭ ਤੋਂ ਵੱਡੀ ਹਾਨੀ ਕਿਸਾਨ ਦੇ ਸਾਹਮਣੇ ਇਹ ਹੁੰਦੀ ਹੈ ਕਿ ਉਹ ਆਪਣੀ ਫ਼ਸਲ ਦਾ ਸੰਪੂਰਨ ਮੁੱਲ ਇੱਕ ਬੀਮੇ ਦੇ ਰੂਪ ਵਿੱਚ ਪ੍ਰਾਪਤ ਨਹੀਂ ਕਰਦਾ ਪ੍ਰੰਤੂ ਕੇਂਦਰ ਸਰਕਾਰ ਵੱਲੋਂ ਇਹ ਬੀਮਾ ਪੋਲਸੀ ਜੋ ਕਿ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਉਸ ਨੂੰ ਮੈਂ ਕਰ ਜੇਕਰ ਮੈਂ ਉਸਨੂੰ ਵਧੀਆ ਮੰਨਦਾ ਹਾਂ ਤਾਂ ਇੱਕ ਉਹ ਵਧੀਆ ਹੋ ਨਿਬੜਦੀ ਹੈ ਕਿਉਂਕਿ ਜੇਕਰ ਇਹ ਪੋਲਸੀ ਨਾ ਕਰਵਾਈ ਜਾਵੇ ਕਿਸਾਨ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਇਹ ਪੋਲਸੀ ਹਰ ਕਿਸਾਨ ਨੂੰ ਨਾ ਦਿੱਤੀ ਜਾਵੇ ਤਾਂ ਹੋ ਸਕਦਾ ਇਹਨਾਂ ਕੁਦਰਤੀ ਆਫ਼ਤਾਂ ਦੇ ਨਾਲ ਕਿਸਾਨ ਦੇ ਫ਼ਸਲ ਦਾ ਕੁਝ ਹਿੱਸਾ ਜੋ ਉਸਨੂੰ ਪ੍ਰਾਪਤ ਹੁੰਦਾ ਹੈ ਉਹ ਵੀ ਪ੍ਰਾਪਤ ਨਾ ਹੋ ਸਕੇ ਸੋ ਫ਼ਸਲ ਬੀਮਾ ਪਾਲਸੀ ਇੱਕ ਬਹੁਤ ਵਧੀਆ ਪੋਲਸੀ ਹੈ ਜੋ ਕਿਸਾਨਾਂ ਦੇ ਲਈ ਇੱਕ ਵਧੀਆ ਉਪਰਾਲਾ ਹੈ ਕੇਂਦਰ ਸਰਕਾਰ ਦੁਆਰਾ ਜੇਕਰ ਇਸ ਨੂੰ ਸਮਝਿਆ ਜਾਵੇ ਤਾਂ ਜਿਹੜੇ ਖੇਤੀਬਾੜੀ ਸੰਮੇਲਨ ਹਨ ਇਹ ਸੰਮੇਲਨ ਇੱਕ ਕਾਰਗਰ ਹੋ ਨਿਬੜਦੇ ਹਨ ਕਿਉਂਕਿ ਬੀਮਾ ਪੋਲਸੀ ਦੇ ਨਾਲ ਨਾਲ ਕਿਸਾਨਾਂ ਨੂੰ ਜਿਵੇਂ ਕਿ ਮੈਂ ਪਹਿਲਾਂ ਹੀ ਚਰਚਾ ਕਰ ਚੁੱਕਿਆ ਹਾਂ ਕਿ ਕਿਸਾਨਾਂ ਨੂੰ ਬੀਜਾਂ ਬਾਰੇ ਕਿਸਾਨਾਂ ਨੂੰ ਪੈਸਟੀਸਾਈਡਜ਼ ਬਾਰੇ ਕਿਸਾਨਾਂ ਨੂੰ ਖਾਦਾਂ ਬਾਰੇ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ ਖੂੰਹਦ ਦੀ ਜੋ ਸਮੱਸਿਆ ਆਉਂਦੀ ਹੈ ਉਸ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਇਸ ਵਿੱਚ ਵੱਡੀ ਸਮੱਸਿਆ ਖੇਤੀ ਦੇ ਆਧੁਨਿਕੀਕਰਨ ਦੇ ਦੌਰਾਨ ਵਾਤਾਵਰਨ ਨੂੰ ਧੂੰਏ ਦੁਆਰਾ ਗੰਧਲਾ ਕਰਨ ਦੀ ਆਉਂਦੀ ਹੈ ਤਾਂ ਇਸ ਨੂੰ ਘੱਟ ਕਰਨ ਦੇ ਲਈ ਇਨਵਾਇਰਮੈਂਟ ਨੂੰ ਜਾਂ ਵਾਤਾਵਰਨ ਨੂੰ ਵਧੀਆ ਰੱਖਣ ਦੇ ਲਈ ਖੇਤੀਬਾੜੀ ਵਿਭਾਗ ਵੱਲੋਂ ਸਮੇਂ ਸਮੇਂ 'ਤੇ ਜੋ ਸੰਮੇਲਨ ਕਰਵਾਏ ਜਾਂਦੇ ਹਨ ਉਹ ਵੀ ਵਧੀਆ ਹੋ ਨਿਬੜਦੇ ਹਨ ਸੋ ਅੰਤ ਵਿੱਚ ਮੈਂ ਇਹ ਹੀ ਅ ਕਹਿਣਾ ਚਾਹਾਂਗਾ ਕਿ ਜੋ ਬੀਮਾ ਪੋਲਸੀ ਕੇਂਦਰ ਸਰਕਾਰ ਦੁਆਰਾ ਹਰ ਇੱਕ ਕਿਸਾਨ ਨੂੰ ਦਿੱਤੀ ਜਾਂਦੀ ਹੈ ਉਹ ਬੀਮਾ ਪੋਲਸੀ ਕਿਸਾਨ ਦੀ ਇੱਕ ਸੱਚੀ ਮਿੱਤਰ ਹੁੰਦੀ ਹੈ ਕਿਉਂਕਿ ਆਫ਼ਤਾਂ ਦੇ ਦੌਰਾਨ ਹੋਏ ਨੁਕਸਾਨ ਦਾ ਕੁਝ ਹਿੱਸਾ ਭਰਪਾਈ ਦੇ ਰੂਪ ਵਿੱਚ ਕਿਸਾਨ ਨੂੰ ਪ੍ਰਾਪਤ ਹੁੰਦਾ ਹੈ ਧੰਨਵਾਦ